ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਕਸਬੇ ਅਤੇ ਇਲਾਕੇ ਪਿੰਡ ਰਹਿਂ ਵਸਦੇ ਹਨ ਇਹਨਾਂ ਵਿੱਚ ਬਹੁਤ ਸਾਰੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ਜਿਵੇਂ ਕਿ ਹੁਣ ਮੈਂ ਵੀ ਇੱਕ ਆਪਣੇ ਪਿੰਡ ਦੀ ਰਹਿਣ ਵਾਲੀ ਹਾਂ ਮੇਰੇ ਪਿਤਾ ਜੀ ਕਿਸਾਨ ਹਨ ਮੈਂ ਜਿੱਥੇ ਤੱਕ ਮੈਨੂੰ ਪਤਾ ਹੈ ਉਹ ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ਜਿਵੇਂ ਕਿ ਕਣਕ ਕਣਕ ਚਾਵਲ ਔਰ ਅਤੇ ਸਬਜ਼ੀਆਂ ਬੈਂਗਣ ਭਿੰਡੀ ਤੋਰੀ ਆਦਿ ਇਹ ਸਾਰੀਆਂ ਚੀਜ਼ਾਂ ਬੀਜੀਆਂ ਜਾਂਦੀਆਂ ਹਨ ਅਤੇ ਜਿਵੇਂ ਹੁਣ ਕਣਕ ਵਿਸਾਖੀ ਦੇ ਦਿਨਾਂ ਵਿੱਚ ਵੱਢੀ ਜਾਂਦੀ ਹੈ ਅਤੇ ਉਹਦੇ ਲਈ ਸਾਨੂੰ ਬਹੁਤ ਹੀ ਜ਼ਿਆਦਾ ਮਤਲਬ ਅਨੁਕੂਲ ਵਾਤਾਵਰਨ ਹੋਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਜੇ ਹੁਣ ਮੈਂ ਗੱਲ ਕਰਾਂ ਕਿ ਚਾਵਲ ਚਾਵਲਾਂ ਦੇ ਚਾਵਲ ਅਸਾਂ ਅਸੀਂ ਮੀਹਾਂ ਦੇ ਦਿਨਾਂ ਵਿੱਚ ਜਮਾਂਦੇ ਹਨ ਅਤੇ ਸਬਜ਼ੀਆਂ ਸਰਦੀਆਂ ਦੇ ਮੌਸਮ 'ਚ ਬੀਜੀਆਂ ਜਾਂਦੀਆਂ ਹਨ ਇਹਨਾਂ ਲਈ ਪ ਅਨੁਕੂਲ ਵਾਤਾਵਰਨ ਵੀ ਹੋਣਾ ਚਾਹੀਦਾ ਹੈ ਅਤੇ ਸ਼ਟਰ ਵਗੈਰਾ ਵੀ ਹੋਣਾ ਚਾਹੀਦਾ ਕਿਉਂਕਿ ਤਾਂ ਜੋ ਇਹਨਾਂ ਨੂੰ ਅਸੀਂ ਕੋਹਰੇ ਤੋਂ ਵੀ ਸੰਭਾਲ ਕੇ ਰੱਖੀਏ